ਹੈਲੋ ਵੀਰੇ ਕੀ ਹਾਲ ਨੇ ਮੈਂ ਤੁਹਾਡੀ ਕੈਬ ਬੁੱਕ ਕਰੀ ਸੀ ਮੈਂ ਰਮਨ ਬੋਲਦਾ ਮੈਂ ਤੁਹਾਡੀ ਕੈਬ ਖੰਨੇ ਤੋਂ ਚੰਡੀਗੜ੍ਹ ਜਾਣ ਲਈ ਪੱਚੀ ਸੌ ਰੁਪਏ ਵਿੱਚ ਬੁੱਕ ਕਰੀ ਸੀ ਅਤੇ ਮੈਂ ਅੱਧੇ ਪੈਸੇ ਤੁਹਾਨੂੰ ਅਡਵਾਂਸ ਦਿੱਤੇ ਸੀ ਅਤੇ ਬਾਕੀ ਮੈਂ ਚੰਡੀਗੜ੍ਹ ਪਹੁੰਚ ਕੇ ਤੁਹਾਨੂੰ ਔਨਲਾਈਨ ਪੇ ਕਰਤੇ ਸੀ ਅਤੇ ਉੱਥੇ ਉਤਰ ਕੇ ਜਦੋਂ ਮੈਂ ਤੁਹਾਨੂੰ ਪੇਮੈਂਟ ਕਰ ਰਿਹਾ ਸੀ ਪਿੱਛੇ ਐਕਸੀਡੈਂਟ ਹੋਣ ਕਾਰਨ ਬਹੁਤ ਭੀੜ ਹੋ ਗਈ ਸੀ ਅਤੇ ਉਹਦੇ ਰੌਲੇ ਰੱਪੇ ਵਿੱਚ ਮੈਂ ਪੇਮੈਂਟ ਕਰਕੇ ਨਿਕਲ ਗਿਆ ਅਤੇ ਬਾਅਦ ਵਿੱਚ ਮੈਂ ਧਿਆਨ ਨਹੀਂ ਦਿੱਤਾ ਮੇਰਾ ਬੈਗ ਤੁਹਾਡੀ ਕੈਬ ਵਿੱਚ ਰਹਿ ਗਿਆ ਸੀ ਮੇਰਾ ਬੈਗ ਪਿਛਲੀ ਸੀਟ 'ਤੇ ਹੀ ਪਿਆ ਰਹਿ ਗਿਆ ਅਤੇ ਮੈਂ ਬਾਅਦ ਵਿੱਚ ਤੁਹਾਨੂੰ ਦੇਖਣ ਲਈ ਵੀ ਗਿਆ ਪਰ ਤੁਸੀਂ ਉੱਥੋਂ ਨਿਕਲ ਗਏ ਸੀ ਬਾਈ ਤੁਹਾਡਾ ਧੰਨਵਾਦ ਹੀ ਹੋਊਗਾ ਮੇਰਾ ਬੈਗ ਫੜਾ ਜਾਂਦੇ ਆ ਕੇ